ਮੈਂ ਆਪਣੀ ਪੇਂਟਿੰਗ ਵਿੱਚ ਜ਼ਿਆਦਾਤਰ ਕਾਰਟੂਨਿੰਗ ਕਰਦੀ ਹਾਂ ਕਾਰਟੂਨਿੰਗ ਦੀਆਂ ਤਕਨੀਕਾਂ ਬਹੁਤ ਸਾਰੀਆਂ ਹਨ ਜਿਸ ਵਿੱਚ ਮੈਨੂੰ ਸਾਰੀਆਂ ਤਾਂ ਨਹੀਂ ਆਉਂਦੀ ਬੱਟ ਕੁਝ ਕੁ ਮੈਨੂੰ ਆਉਂਦੀਆਂ ਹਨ ਜਿਵੇਂ ਕਿ ਕਾਰਟੂਨ ਕਿੱਦਾਂ ਡਰਾਅ ਕਰਨੇ ਉਹਨਾਂ ਨੂੰ ਐਕਸਪ੍ਰੈਸ਼ਨਜ਼ ਕਿੱਦਾਂ ਦੇਣੇ ਉਹ ਸਾਰੀਆਂ ਤਕਨੀਕਾਂ ਅਤੇ ਉਨ੍ਹਾਂ ਦੇ ਬੋਡੀ ਲੈਂਗੁਏਜ ਵਗੈਰਾ ਕਿੱਦਾਂ ਅਸੀਂ ਉਸ ਉਨ੍ਹਾਂ ਦੇ ਪਾਤਰ ਨੂੰ ਡਰੋਅ ਕਰਨਾ ਹੈ ਇਹ ਸਾਰੀਆਂ ਤਕਨੀਕਾਂ ਮੈਂ ਆਪਣੇ ਦੋ ਟੀਚਰਸ ਤੋਂ ਸਿੱਖੀਆਂ ਇੱਕ ਉਹ ਦੋਨੋਂ ਮੈਨੂੰ ਯੂਥ ਫੇਸਟ ਵਿੱਚ ਹੇ ਮਿਲੇ ਸੀ ਜਦ ਮੇਰੇ ਕਾਲਜ ਦੇ ਵਿੱਚ ਯੂਥ ਫੈਸਟੀਵਲ ਹੋਇਆ ਸੀ ਤਾਂ ਮੇਰੇ ਭਾਗ ਲਿੱਤਾ ਮੈਂ ਭਾਗ ਲਿੱਤਾ ਸੀ ਅਤੇ ਓਥੇ ਦੇ ਟੀਚਰ ਹੀ ਜਿਹੜੇ ਸੀ ਜਿਹੜੇ ਸਿਖਾਉਂਦੇ ਸਨ ਸਭ ਤੋਂ ਪਹਿਲਾਂ ਸੀ ਰੋਮੀ ਸਰ ਜਿਹਨਾਂ ਨੇ ਮੈਨੂੰ ਕਾਰਟੂਨਿੰਗ ਵਿੱਚ ਇਸਤੇਮਾਲ ਹੋਣ ਵਾਲੇ ਕਲਰਸ ਬਾਰੇ ਬਹੁਤ ਹੀ ਜ਼ਿਆਦਾ ਜਾਣਕਾਰੀ ਦਿੱਤੀ ਕਾਰਟੂਨਿੰਗ ਵਿੱਚ ਵਾਟਰ ਕਲਰਸ ਇਸਤੇਮਾਲ ਹੁੰਦੇ ਹਨ ਕਿਵੇਂ ਵਾਟਰ ਕਲਰਸ ਨਾਲ ਤੁਸੀਂ ਐਕਸਪ੍ਰੈਸ਼ਨਜ਼ ਦੇ ਸਕਦੇ ਹੋ ਇੱਕ ਤਾਂ ਡਰਾਇੰਗ ਨੂੰ ਡਰੋਅ ਕਰਨਾ ਤਾਂ ਹੁੰਦਾ ਹੀ ਹੈ ਪਰ ਤੁਸੀਂ ਕਲਰਸ ਨਾਲ ਕਿੱਦਾਂ ਐਕਸਪ੍ਰੈਸ਼ਨਸ ਦੇਣੇ ਉਹ ਤੇ ਕਿਹੜੇ ਕਲਰਸ ਨੂੰ ਕਿੱਥੇ ਤੋਂ ਡਾਰਕ ਕਰਨਾ ਕਿੱਥੋਂ ਲਾਈਟ ਕਰਨਾ ਇਹ ਸਾਰਾ ਕੁਝ ਮੈਨੂੰ ਰੋਮੀ ਸਰ ਨੇ ਦੱਸਿਆ ਸੀ ਅਤੇ ਦੂਜੀ ਵਾਰ ਜਦ ਮੈਂ ਯੂਥ ਫੈਸਟ ਵਿੱਚ ਪਾਰਟੀਸੀਪੇਟ ਕੀਤਾ ਤਾਂ ਸਾਡੇ ਜਸ਼ਨ ਮੈਮ ਸੀ ਜਿਨ੍ਹਾਂ ਨੇ ਸਾਨੂੰ ਸਿਖਾਇਆ ਸੀ ਜਸ਼ਨ ਮੈਮ ਨੇ ਸਾਡੀ ਡਿਟੇਲਿੰਗ ਅਤੇ ਬੇਸਿਕ ਵਰਕ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਸੀ ਉਹ ਉਹਨਾਂ ਨੇ ਐਮ ਉਹਨਾਂ ਨੇ ਡਰਾਇੰਗ ਵਿੱਚ ਮਾਸਟਰਿੰਗ ਕੀਤੀ ਸੀ ਤਾਂ ਉਨ੍ਹਾਂ ਨੂੰ ਬੇਸਿਕ ਚੀਜ਼ਾਂ ਬਾਰੇ ਬਹੁਤ ਸਾਰਾ ਅੱਛੇ ਢੰਗ ਨਾਲ ਪਤਾ ਸੀਗਾ ਉਹਨਾਂ ਨੇ ਮੈਨੂੰ ਕਿਸੇ ਦਾ ਚਿਹਰਾ ਕਿੱਦਾਂ ਡਰੋ ਕਰਨਾ ਹੈ ਉਹ ਸਾਰਾ ਕੁਝ ਉਹਨਾਂ ਨੇ ਮੈਨੂੰ ਦੱਸਿਆ ਸੀ ਅਤੇ ਔਨਲਾਈਨ ਸਰੋਤ ਦੀ ਜੇ ਮੈਂ ਗੱਲ ਕਰਾਂ ਤਾਂ ਹਾਂ ਮੇਰੇ ਕੋਲ ਇੱਕ ਔਨਲਾਈਨ ਸਰੋਤ ਵੀ ਹੈ ਯੂਥ ਫੈਸਟ ਤੋਂ ਬਾਅਦ ਮੇਰਾ ਆਪਣੇ ਟੀਚਰਸ ਨਾਲ ਇੰਨਾ ਇੰਨਾ ਗੱਲ ਬਾਤ ਨਹੀਂ ਰਹੀ ਕਿ ਮੈਂ ਉਹਨਾਂ ਤੋਂ ਪੁੱਛ ਸਕਾਂ ਕਿ ਕਿਵੇਂ ਕਿਆ ਕਰਨਾ ਹੈ ਤਾਂ ਮੈਂ ਔਨਲਾਈਨ ਉਹਨਾਂ ਨਾਲ ਫੋਨ 'ਤੇ ਗੱਲ ਵਗੈਰਾ ਕਰ ਲੈਂਦੀ ਹਾਂ ਆਪਣੀ ਡਰਾਇੰਗ ਦੀ ਫੋਟੋ ਖਿੱਚ ਕੇ ਉਹਨਾਂ ਤੋਂ ਪੁੱਛ ਲੈਂਦੀ ਹਾਂ ਉਸ ਤੋਂ ਇਲਾਵਾ ਮੈਂ ਇੰਸਟਾਗ੍ਰਾਮ ਜਾਂ ਯੂਟਿਊਬ ਵਗੈਰਾ 'ਤੇ ਵੀਡੀਓਸ ਦੇਖਦੀ ਰਹਿੰਦੀ ਹਾਂ ਅਤੇ ਆਪਣਾ ਤਕਨੀਕਾਂ ਨੂੰ ਹੋਰ ਸੁਧਾਰਦੀ ਹਾਂ